ਗਾਉਣ ਦੇ ਸੰਬੰਧਿਤ ਨੂੰ ਲੈ ਕੇ ਮੇਰੇ ਭਵਿੱਖ ਵਿੱਚ ਬਹੁਤ ਇੱਛਾਵਾਂ ਹਨ ਇਹਨਾਂ ਇੱਛਾਵਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਵਧੀਆ ਗਾਇਕਾ ਬਣਨਾ ਚਾਹੁੰਦੀ ਹਾਂ ਗਾਇਕਾ ਮੈਂ ਸਿਰਫ ਪੰਜਾਬੀ ਲੋਕ ਗੀਤਾਂ ਨਾਲ ਹੀ ਸੰਬੰਧਿਤ ਬਣਨਾ ਚਾਹੁੰਦੀ ਹਾਂ ਕਿਉਂਕਿ ਮੇਰੀ ਸਭ ਤੋਂ ਵੱਡੀ ਇਹ ਇੱਛਾ ਹੈ ਕਿ ਮੇਰੇ ਗਾਉਣ ਦੇ ਨਾਲ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਅਤੇ ਕੋਈ ਆਪਣੇ ਆਪ ਨੂੰ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਨਾ ਹੋਵੇ ਅਤੇ ਮੇਰੀ ਦੂਜੀ ਇੱਛਾ ਇਹ ਹੈ ਕਿ ਜਦ ਮੈਂ ਸਭ ਦੇ ਸਾਹਮਣੇ ਸਟੇਜ 'ਤੇ ਗਾਵਾਂ ਉਸ ਸਮੇਂ ਮੇਰੇ ਸਭ ਤੋਂ ਨਜ਼ਦੀਕੀ ਮਾਂ ਬਾਪ ਮੇਰੇ ਸਾਹਮਣੇ ਹੋਣ ਅਤੇ ਉਹਨਾਂ ਨੂੰ ਮੈਨੂੰ ਗਾਉਂਦੇ ਨੂੰ ਦੇਖ ਕੇ ਫਕਰ ਹੋਵੇ ਕਿ ਹਾਂ ਸਾਡੇ ਬੱਚੇ ਨੇ ਬਹੁਤ ਵਧੀਆ ਗਾਇਆ ਹੈ ਅਤੇ ਮੈਂ ਆਪਣੇ ਗਾਉਣ ਦੀ ਇਨ ਦੀ ਇੱਛਾ ਨੂੰ ਅੱਗੇ ਨੈਸ਼ਨਲ ਲੈਵਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਲਿਜਾਣਾ ਚਾਹੁੰਦੀ ਹਾਂ ਕਿਉਂਕਿ ਮੈਂ ਪੰਜਾਬੀ ਗਾਇਕੀ ਨੂੰ ਸਿਰਫ ਕੇਵਲ ਭਾਰਤ ਦੇ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅੱਗੇ ਲਿਆਉਣਾ ਚਾਹੁੰਦੀ ਹਾਂ ਕਿਉਂਕਿ ਸਾਡੀ ਪੰਜਾਬੀ ਗਾਇਕੀ ਬਹੁਤ ਅੱਗੇ ਜਾਣੀ ਚਾਹੀਦੀ ਹੈ ਜਿਸ ਸਭ ਤੋਂ ਵੱਡੀ ਮੇਰੀ ਇਹ ਇੱਛਾ ਹੈ ਕਿ ਮੈਂ ਪੰਜਾਬੀ ਗਾਇਕੀ ਨੂੰ ਦੇਸ਼ ਵਿਦੇਸ਼ ਤੱਕ ਲੈ ਕੇ ਜਾਵਾਂ